ਕੱਲ੍ਹ ਪੰਜਾਬ ਰੋਡਵੇਜ਼ ਦੀ ਬੱਸ ਨਵਾਂਸ਼ਹਿਰ ਤੋਂ ਜਲੰਧਰ ਤੱਕ ਗਈ ਬੜਾ ਵਧੀਆ ਉਹਦਾ ਸਫ਼ਰ ਸੀ ਔਰ ਡਰਾਈਵਰ ਦਾ ਬੜਾ ਅੱਛਾ ਬੀਹੇਵੀਅਰ ਸੀ ਬੜਾ ਘੱਟ ਉਹਨੇ ਹਾਰਨ ਵਜਾਇਆ ਔਰ ਜਿਹੜਾ ਉਹਦਾ ਕੰਡਕਟਰ ਸੀ ਉਹਨੇ ਵੀ ਬੜਾ ਅੱਛੇ ਤਰੀਕੇ ਦੇ ਨਾਲ਼ ਸਵਾਰੀਆਂ ਨਾਲ਼ ਡੀਲ ਕੀਤਾ